ਹਾਂ ਮੈਂ ਇੱਕ ਅਜਿਹੀ ਕਿਤਾਬ ਪੜ੍ਹੀ ਹੈ ਜਿਸ ਨੂੰ ਪੜ੍ਹਨ ਤੋਂ ਬਾਅਦ ਮੈਂ ਕਾਫੀ ਭਾਵਕ ਹੋਈ ਸਾਂ ਅਤੇ ਕਿਹਾ ਜਾਵੇ ਰੋਈ ਵੀ ਸਾਂ ਇਸ ਕਿਤਾਬ ਦਾ ਨਾਮ ਸੀ ਪ੍ਰੇਮ ਦਾ ਉਪਹਾਰ ਇਸ ਕਿਤਾਬ ਦੇ ਵਿੱਚ ਇੱਕ ਜੋ ਕਹਾਣੀ ਦਿੱਤੀ ਗਈ ਸੀ ਤਾਂ ਉਹ ਇਸ ਪ੍ਰਕਾਰ ਸੀ ਨਾਇਕਾ ਜੋ ਹੈ ਅਤੇ ਨਾਇਕ ਹੈ ਦੋਨੋਂ ਇੱਕੋ ਕੋਲਜ ਦੇ ਵਿਦਿਆਰਥੀ ਹਨ ਉਹਨਾਂ ਦੀ ਕੋਲਜ ਦੀ ਜ਼ਿੰਦਗੀ ਦਿਖਾਈ ਗਈ ਹੈ ਦੋਨੋਂ ਇੱਕ ਦੂਜੇ ਨੂੰ ਬਹੁਤ ਪ੍ਰੇਮ ਕਰਦੇ ਹਨ ਪਰ ਜੋ ਉਹਨਾਂ ਦੇ ਵਿੱਚ ਅਸਲ ਫ਼ਰਕ ਹੈ ਉਹ ਹੈ ਆਰਥਿਕਤਾ ਦਾ ਨਾਇਕਾ ਇਕ ਅਮੀਰ ਘਰ ਦੀ ਲੜਕੀ ਹੈ ਅਤੇ ਨਾਇਕ ਇੱਕ ਬਹੁਤ ਹੀ ਗਰੀਬ ਘਰ ਦਾ ਲੜਕਾ ਹੈ ਜਿਉਂ ਹੀ ਨਾਇਕਾ ਦੇ ਪਿਤਾ ਦੇ ਸਾਹਮਣੇ ਨਾਇਕਾ ਆਪਣੇ ਪ੍ਰੇਮ ਦਾ ਇਜ਼ਹਾਰ ਕਰਦੀ ਹੈ ਉਹ ਸ਼ਾਦੀ ਲਈ ਆਪਣੇ ਪਿਤਾ ਦੀਆਂ ਮਿੰਨਤਾਂ ਕਰਦੀ ਹੈ ਤਾਂ ਉਸ ਦਾ ਪਿਤਾ ਉਸ ਨੂੰ ਉਸ ਜਗ੍ਹਾ ਤੋਂ ਕਿਤੇ ਹੋਰ ਲੈ ਜਾਂਦਾ ਹੈ ਤਾਂ ਇਸ ਤੋਂ ਬਾਅਦ ਨਾਇਕ ਜਦੋਂ ਆਪਣੇ ਘਰ ਤੋਂ ਵਾਪਸ ਪਰਤਦਾ ਹੈ ਤਾਂ ਉਹ ਦੇਖਦਾ ਹੈ ਕਿ ਨਾਇਕਾ ਕੋਲਜ ਨੂੰ ਛੱਡ ਚੁੱਕੀ ਹੁੰਦੀ ਹੈ ਤਾਂ ਇਹ ਜੋ ਦ੍ਰਿਸ਼ ਸੀ ਇਸ ਨ ਉਪਨਿਆਸ ਨਾਵਲ ਦਾ ਤਾਂ ਉਹ ਮੇਰੇ ਲਈ ਬੜਾ ਹੀ ਭਾਵੁਕ ਸੀ ਇਸ ਨੂੰ ਪੜ੍ਹਨ ਤੋਂ ਬਾਅਦ ਮੇਰਾ ਮਨ ਬੜਾ ਹੀ ਬੇਚੈਨ ਦੁਖੀ ਹੋਇਆ ਅਤੇ ਪਰ ਅੰਤ ਦੇ ਵਿੱਚ ਇਸ ਉਪ ਨਾਵਲ ਦੇ ਵਿੱਚ ਜੇ ਸ਼ੁਰੂਆਤ ਵਿੱਚ ਇੱਕ ਰੋਣਾ ਸੀ ਭਾਵੁਕਤਾ ਸੀ ਪਰ ਅੰਤ ਦੇ ਵਿੱਚ ਖੁਸ਼ੀ ਵਾਲਾ ਦ੍ਰਿਸ਼ ਸਿਰਜਿਆ ਗਿਆ ਸੀ ਅੰਤ ਦੇ ਵਿੱਚ ਆ ਕੇ ਨਾਇਕਾ ਅਤੇ ਨਾਇਕ ਦੋਨੋਂ ਆਪਸ ਦੇ ਵਿੱਚ ਮਿਲ ਜਾਂਦੇ ਹਨ ਤਾਂ ਨਾਇਕ ਜੋ ਹੁੰਦਾ ਹੈ ਕਿਸੇ ਪਿੰਡ ਵਿੱਚ ਚਲਾ ਜਾਂਦਾ ਹੈ ਉੱਥੇ ਉਹ ਆਤੰਕਵਾਦੀਆਂ ਦਾ ਮੁਕਾਬਲਾ ਕਰਦਾ ਹੈ ਅਤੇ ਉਸ ਲੜਕੀ ਦਾ ਪਿਤਾ ਜੋ ਜਿਹਨਾਂ ਨੇ ਇਹਨਾਂ ਦੋਨਾਂ ਨੂੰ ਆਪਸ ਵਿੱਚੋਂ ਦੂਰ ਕੀਤਾ ਸੀ ਆਰਮੀ ਦਾ ਅਫਸਰ ਸੀ ਜਿਉਂ ਹੀ ਉਸ ਨੂੰ ਪਤਾ ਚੱਲਦਾ ਹੈ ਕਿ ਉਸ ਨੇ ਆਤੰਕਵਾਦੀਆਂ ਨੂੰ ਹਰਾ ਦਿੱਤਾ ਹੈ ਜਾਂ ਮਾਰ ਦਿੱਤਾ ਹੈ ਤੋ ਬੜਾ ਖੁਸ਼ ਹੁੰਦਾ ਹੈ ਤਾਂ ਉਹ ਨਾਇਕਾ ਜੋ ਕਿ ਉਸ ਚੀਜ਼ ਤੋਂ ਬਾਅਦ ਬੜੇ ਹੀ ਡਿਪਰੈਸ਼ਨ ਦੇ ਵਿੱਚ ਆ ਗਈ ਸੀ ਉਸ ਦੇ ਵਿਛੜਨ ਤੋਂ ਬਾਅਦ ਜਦੋਂ ਉਸ ਨੂੰ ਲੈ ਕੇ ਆਇਆ ਜਾਂਦਾ ਹੈ ਤਾਂ ਨਾਇਕ ਉਸ ਨਾਇਕਾ ਦੀ ਪੁਰਾਣੀ ਯਾਦਦਾਸ਼ਤ ਜੋ ਖੋ ਚੁੱਕੀ ਸੀ ਉਸ ਤੋਂ ਵਾਪਸ ਲੈ ਕੇ ਆਉਂਦਾ ਹੈ ਉਸ ਨੂੰ ਸਾਰੀਆਂ ਉਸ ਦੀਆਂ ਜੋ ਚੀਜ਼ਾਂ ਸਨ ਯਾਦਾਂ ਸਨ ਉਸ ਨੂੰ ਦੁਬਾਰਾ ਤੋਂ ਤਾਜ਼ਾ ਕਰਵਾਈਆਂ ਜਾਂਦੀਆਂ ਹਨ ਤਾਂ ਇਸ ਪ੍ਰਕਾਰ ਉਸ ਦੇ ਠੀਕ ਹੋਣ ਤੋਂ ਬਾਅਦ ਨਾਇਕਾ ਦਾ ਜੋ ਵਿਆਹ ਹੈ ਉਸ ਨਾਇਕ ਦੇ ਨਾਲ ਹੋ ਜਾਂਦਾ ਹੈ ਤਾਂ ਦੁੱਖ ਦੇ ਨਾਲ ਨਾਲ ਭਾਵੁਕਤਾ ਦੇ ਨਾਲ ਨਾਲ ਰੋਣ ਦੇ ਨਾਲ ਨਾਲ ਅੰਤ ਇਸ ਨਾਵਲ ਦਾ ਬੜਾ ਹੀ ਖੁਸ਼ੀ ਭਰਿਆ ਹੁੰਦਾ ਹੈ